ਸਤਿ ਸ਼੍ਰੀ ਅਕਾਲ ਸਰ ਮੈਂ ਤੁਹਾਡੀ ਵੈਬਸਾਈਟ ਤੋਂ ਸਤਾਰਾਂ ਜੂਨ ਨੂੰ ਆਈ ਫ਼ੋਨ ਐਕਸਐੱਸ ਖਰੀਦਿਆ ਸੀ ਅਤੇ ਤਕਰੀਬਨ ਚਾਰ ਦਿਨ ਦੇ ਵਿੱਚ ਵਿੱਚ ਹੀ ਮੇਰੇ ਘਰ ਪਹੁੰਚ ਗਿਆ ਇਸ ਗੱਲ ਦੀ ਮੈਨੂੰ ਬੇਹੱਦ ਖੁਸ਼ੀ ਹੈ ਕਿ ਤੁਹਾਡੀ ਡਿਲੀਵਰੀ ਸਰਵਿਸ ਬਹੁਤ ਤੇਜ਼ੀ ਨਾਲ ਕੰਮ ਕਰਦੀ ਹੈ ਉਨ੍ਹਾਂ ਨੇ ਮੈਨੂੰ ਹਫਤੇ ਤੋਂ ਪਹਿਲਾਂ ਹੀ ਮੇਰਾ ਮੋਬਾਇਲ ਘਰ ਪੁੱਜਦਾ ਕਰ ਦਿੱਤਾ ਇਸ ਮੋਬਾਇਲ ਦਾ ਮੈਨੂੰ ਮੋਹ ਤਾਂ ਵਾਲਾ ਸੀ ਅਤੇ ਜਦੋਂ ਚਲਾ ਕੇ ਦੇਖਿਆ ਤਾਂ ਹੋਰ ਵੀ ਖੁਸ਼ੀ ਨਾਲ ਦੂਣਾ ਹੋ ਗਿਆ ਇਸ ਵਿੱਚ ਇੰਨੇ ਫੀਚਰ ਹਨ ਕਿ ਗਿਣਦਾ ਹੀ ਬੰਦਾ ਥੱਕ ਜਾਂਦਾ ਹੈ ਕੀ ਕੈਮਰੇ ਦੀ ਇਸ ਦੀ ਗੱਲ ਕਰੀਏ ਕੈਮਰੇ ਦੀ ਗੱਲ ਵੀਡੀਓਗ੍ਰਾਫੀ ਵੀ ਵਧੀਆ ਹੋ ਜਾਂਦੀ ਹੈ ਇਸ ਤੋਂ ਇਲਾਵਾ ਅਵਾਜ਼ ਦੀ ਕੋਆਲਟੀ ਵੀ ਬਹੁਤ ਵਧੀਆ ਹੈ ਇਸ ਤੋਂ ਇਲਾਵਾ ਕੋਈ ਵੀ ਲੈਗ ਮੋਬਾਇਲ ਵਿੱਚ ਦੇਖਣ ਨੂੰ ਨਹੀਂ ਮਿਲਦਾ ਬਿਲਕੁਲ ਸਰਲ ਤਰੀਕੇ ਨਾਲ ਮੋਬਾਇਲ ਕੰਮ ਕਰਦਾ ਹੈ ਸਕਿਓਰਟੀ ਵਜੋਂ ਦੇਖਿਆ ਜਾਵੇ ਤਾਂ ਵੀ ਇਹ ਬਹੁਤ ਉਮਦਾ ਮੋਬਾਇਲ ਹੈ